ਉਰੇ ਜਿੱਥੇ ਵੀ ਬੱਸਾਂ ਰੁਕਦੀਆਂ ਉੱਥੇ ਸੀਵਰੇਜ 'ਚ ਪਾਣੀ ਲੀਕੇਜ ਹੁੰਦਾ ਨੱਕੋ ਨੱਕ ਭਰੇ ਹੋਏ ਆ ਭਰੇ ਹੋਇਆ ਅਤੇ ਬਿਮਾਰੀਆਂ ਲੱਗਣ ਦਾ ਵੀ ਖ਼ਤਰਾ ਹੀ ਆ ਖ਼ਤਰਾ ਹੀ ਆ ਤਕਰੀਬਨ ਖ਼ਤਰਾ ਕੀ ਹਮੇਸ਼ਾ ਉੱਥੀ ਬੱਸਾਂ ਖੜ੍ਹਦੀਆਂ ਉੱਥੀ ਆ ਜਿਹੜੇ ਆ ਕੇ ਬਾਹਰੋਂ ਭਈਏ ਯੂ ਪੀ ਦੇ ਉਹ ਗੇਰ ਦਿੰਦੇ ਆ ਆਪਣੇ ਉਵੇਂ ਸ਼ਿਖਰ ਪਾਨ ਸਾਰਾ ਕੁਝ ਉਹਦੇ ਕਰਕੇ ਬਹੁਤ ਹੀ ਸਮੱਸਿਆ ਤਾਂ ਹੈਗੀਆਂ ਅਤੇ ਹੁਣ ਜੇ ਆਪਾਂ ਪਿੰਡਾਂ ਨੂੰ ਰੂਟ ਲਾਈਏ ਤਾਂ ਉਦੋਂ ਉੱਥੇ ਸੜਕਾਂ ਨਹੀਂ ਚੱਜ ਦੀਆਂ ਹੈਗੀਆਂ ਸੜਕਾਂ 'ਤੇ ਟੋਆ ਟੱਪਾ ਇੰਨਾ ਵੀ ਜਾਂਦੇ ਜਾਂਦੇ ਹੀ ਧਰਨ ਪੈ ਜਾਂਦੀ ਤਕਰੀਬਨ ਪੁਰਾਣੀਆਂ ਬੁੜੀਆਂ ਤਾਂ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਵੀ ਆ ਨੌਜਵਾਨ ਤਾਂ ਐਂ ਚਲ ਚ ਖੜ੍ਹ ਖੁੜ੍ਹ ਕੇ ਚੱਲ ਪੈਂਦੇ ਆ ਅਤੇ ਗੱਲ ਐਂ ਵੀ ਯਾਤਰਾ ਵਿੱਚ ਰੂਟ ਤਾਂ ਰੂਟ ਤਾਂ ਹੈਗੇ ਹਾਂ ਬਥੇਰੇ ਆ ਇਹੋ ਜਿਹੇ ਜਿਹਨਾਂ 'ਚ ਭੀੜ ਰਹਿੰਦੀ ਆ ਜਿਵੇਂ ਵੀ ਲਾ ਲਓ ਮੋਰਿੰਡੇ ਤੋਂ ਅੰਮ੍ਰਿਤਸਰ ਇੱਕੋ ਟ੍ਰੇਨ ਚੱਲਦੀ ਆ ਉਹਦੇ ਵਿੱਚ ਕਾਫ਼ੀ ਜ਼ਿਆਦਾ ਭੀੜ ਮੰਨ ਲਓ ਕਿ ਇੱਕ ਡੱਬੇ 'ਚ ਸੌ ਕੁ ਸੀਟਾਂ ਹੁੰਦੀਆਂ ਪੰਜ ਸੌ ਬੰਦਾ ਚੜ੍ਹਿਆ ਹੁੰਦਾ ਇਹ ਵੀ ਦੇਖਣਾ ਚਾਹੀਦਾ